ਸਾਡੀ ਸਟੇਟ ਟਰਾਂਸਪੋਰਟ ਦੀ ਕੁਆਲਿਟੀ ਬਹੁਤ ਚੰਗੀ ਹੈ ਬਿਲਕੁਲ ਨਹੀਂ ਸਾਡੀ ਸਟੇਟ ਤੋਂ ਭਾਰਤ ਦੀ ਯਾਤਰਾ ਕਰਨ ਵਿੱਚ ਟਰਾਂਸਪੋਰਟ ਕਰਕੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਮੇਰੀ ਸਟੇਟ ਵਿੱਚ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਾਣ ਲਈ ਟਰਾਂਸਪੋਰਟ ਦੀ ਸੁਵਿਧਾ ਉਪਲੱਬਧ ਹੈ